ਇੱਕ ਜਨਵਰੀ ਉੱਨੀ ਸੌ ਇਕਾਨਵੇਂ ਚਾਰ ਜੂਨ ਉੱਨੀ ਸੌ ਸੱਠ ਦਸ ਮਾਰਚ ਉੱਨੀ ਸੌ ਅਠਾਹਠ ਸੱਤ ਦਸ ਉੱਨੀ ਸੋ ਇਕਾਨਵੇਂ ਤੇਈ ਅਗਸਤ ਉੱਨੀ ਸੌ ਤਰਾਨਵੇਂ